ਹਾਂਜੀ ਮੈਂ ਵਿਹਲਾ ਸਮਾਂ ਆਪਣਾ ਇਸ ਤਰ੍ਹਾਂ ਬਤੀਤ ਕਰਦਾ ਹਾਂ ਮੈਂ ਪਹਿਲਾਂ ਸਵੇਰੇ ਉੱਠਦਾ ਹਾਂ ਆਪਣਾ ਗੁਰੂ ਘਰ ਚਲਾ ਜਾਂਦਾ ਹਾਂ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਸੇਵਾ ਕਰਦਾ ਹਾਂ ਸੇਵਾ ਕਰਨ ਤੋਂ ਬਾਅਦ ਮੈਂ ਗੁਰੂ ਘਰ ਤੋਂ ਆ ਕੇ ਆਪਣੇ ਯਾਰਾਂ ਦੋਸਤਾਂ ਨਾਲ਼ ਘੁੰਮਣ ਚਲਾ ਜਾਂਦਾ ਹਾਂ ਮੈਂ ਆਪਣੇ ਯਾਰਾਂ ਦੋਸਤਾਂ ਨਾਲ਼ ਜ਼ਿਆਦਾਤਰ ਸਮਾਂ ਬਤੀਤ ਕਰਦਾ ਹਾਂ ਇਸ ਨਾਲ਼ ਮੈਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ ਯਾਰਾਂ ਦੋਸਤਾਂ ਨੂੰ ਮਿਲ ਕੇ ਉਹਨਾਂ ਨਾਲ਼ ਸਮਾਂ ਬਤੀਤ ਕਰਕੇ ਮੈਂ ਆਪਣਾ ਗਰਾਊਂਡ ਜਾਂਦਾ ਹਾਂ ਗਰਾਊਂਡ ਜਾ ਕੇ ਮੈਂ ਕ੍ਰਿਕਟ ਖੇਡਦਾ ਹਾਂ ਅਤੇ ਆਪਣਾ ਵਰਕਆਊਟ ਕਰਦਾ ਹਾਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਘੋੜੇ ਉੱਤੇ ਬੈਠ ਕੇ ਉਸਨੂੰ ਗੇੜਾ ਦਿਵਾਉਣ ਚਲਾ ਜਾਂਦਾ ਹਾਂ ਉਸਨੂੰ ਖੇਤਾਂ ਵਿੱਚ ਲਿਜਾ ਕੇ ਉਸ ਦੀ ਦੌੜ ਲਗਵਾਉਂਦਾ ਹਾਂ ਅਤੇ ਉਸਨੂੰ ਮੈਂ ਇੱਕ ਦਰਖ਼ਤ ਦੇ ਨਾਲ਼ ਬੰਨ ਕੇ ਆਪਣਾ ਖੇਤਾਂ ਵਿੱਚ ਕੰਮ ਕਰਦਾ ਹਾਂ ਖੇਤਾਂ ਵਿੱਚ ਕੰਮ ਕਰਕੇ ਮੈਂ ਆਪਣਾ ਘਰ ਵਾਪਸ ਆਉਂਦਾ ਹਾਂ ਅਤੇ ਫਿਰ ਮੈਂ ਟੀ ਵੀ ਦੇਖਦਾ ਹਾਂ ਟੀ ਵੀ ਦੇਖਣ ਤੋਂ ਬਾਅਦ ਸ਼ਾਮ ਨੂੰ ਮੈਂ ਫਿਰ ਗੁਰੂ ਘਰ ਜਾਂਦਾ ਹਾਂ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਮੈਂ ਉੱਥੇ ਸੇਵਾ ਕਰਦਾ ਹਾਂ ਮੈਂ ਜ਼ਿਆਦਾਤਰ ਲੰਗਰ ਵਿੱਚ ਗੁਰੂ ਘਰ ਜਾ ਕੇ ਸੇਵਾ ਕਰਦਾ ਹਾਂ ਉਸ ਤੋਂ ਬਾਅਦ ਮੈਂ ਕਿਸੇ ਸ਼ਹਿਰ ਜਾਂਦਾ ਹਾਂ ਘੁੰਮਣ ਵਾਸਤੇ ਇਸ ਤਰ੍ਹਾਂ ਮੇਰਾ ਵਿਹਲਾ ਸਮਾਂ ਬਤੀਤ ਹੋ ਜਾਂਦਾ ਹੈ